ਮੇਰੇ ਦੁਆਰਾ ਡਾਊਨਲੋਡ ਕੀਤੀ ਗਈ ਆਖਰੀ ਐਪ ਇੱਕ ਗੇਮ ਜਿਸ ਨੂੰ ਮੈਂ ਆਪਣੀ ਬੇਟੀ ਦੇ ਲਈ ਡਾਊਨਲੋਡ ਕੀਤਾ ਹੈ ਉਸ ਵਿੱਚ ਬੋਨਸ ਅਤੇ ਮੈਥ ਹੈ ਜਿਸਨੂੰ ਮੇਰੀ ਬੇਟੀ ਦੇਖ ਕੇ ਸੁਣ ਕੇ ਬਹੁਤ ਕੁਝ ਸਿੱਖਦੀ ਹੈ ਮੈਂ ਆਪਣੇ ਫੋਨ ਵਿੱਚ ਬਹੁਤ ਸਾਰੀਆਂ ਐਪਸ ਯੂਸ ਕਰਦੀ ਹਾਂ ਜਿਸ ਵਿੱਚ ਵਟਸਐਪ ਗੂਗਲ ਪੇ ਫੇਸਬੁਕ ਯੂਟਿਊਬ ਹੈ ਜਿਹਨਾਂ ਵਿੱਚੋਂ ਗੂਗਲ ਪੇ ਦੀ ਵਰਤੋਂ ਮੈਂ ਕਿਸੇ ਨੂੰ ਪੈਸੇ ਭੇਜਣ ਅਤੇ ਲੈਣ ਵਾਸਤੇ ਕਰਦੀ ਹਾਂ ਵਟਸਐਪ ਦੀ ਵਰਤੋਂ ਮੈਂ ਫਰੈਂਡਸ ਨੂੰ ਰਿਲੇਟਿਵਸ ਨੂੰ ਮੈਸੇਜਿਸ ਕੋਲਸ ਕਰਨ ਲਈ ਵਰਤਦੀ ਹਾਂ ਔਰ ਫੇਸਬੁਕ 'ਤੇ ਨਿਊਜ਼ ਵਗੈਰਾ ਦੇਖਣ ਲਈ ਵੀਡੀਓਜ਼ ਦੇਖਣ ਲਈ ਕਰਦੀ ਹਾਂ ਯੂਟੀਊਬ ਦੀ ਵਰਤੋਂ ਮੈਂ ਬਹੁਤ ਸਾਰੀਆਂ ਵੀਡੀਓਸ ਕੁਝ ਨਵਾਂ ਸਿੱਖਣ ਲਈ ਕੁਝ ਨਿਆ ਨਿਆ ਸਿੱਖਦੀ ਹਾਂ ਉਸ ਤੋਂ ਦੇਖ ਕੇ ਇਸ ਲਈ ਉਸਦੀ ਵਰਤੋਂ ਕਰਦੀ ਹਾਂ ਧੰਨਵਾਦ ਜੀ